ਹੈਲੋ ਤੁਸੀਂ ਰਾਜ ਹੋਟਲ ਤੋਂ ਗੱਲ ਕਰ ਰਹੇ ਹੋ ਮੈਂ ਨਵਨੀਤ ਗੱਲ ਕਰ ਰਹੀ ਹਾਂ ਮੈਂ ਤੁਹਾਡੇ ਹੋਟਲ 'ਤੇ ਔਡਰ ਕੀਤਾ ਖਾਣਾ ਔਡਰ ਕੀਤਾ ਸੀ ਉਹ ਖਾਣਾ ਪਹਿਲਾਂ ਤਾਂ ਗਲਤ ਔਡ ਐਡਰੈਸ 'ਤੇ ਪਹੁੰਚ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਮੈਂ ਉਸ ਡਿਲੀਵਰੀ ਵਾਲੇ ਲੜਕੇ ਨੂੰ ਕਾਲ ਕੀਤੀ ਉ ਫਿਰ ਉਸਨੇ ਮੈਨੂੰ ਮੇਰੇ ਔਡਰ 'ਤੇ ਸਹੀ ਜਗ੍ਹਾ ਅ ਖਾਣਾ ਭੇਜਿਆ ਬਟ ਜਿਹੜਾ ਤੁਹਾਡਾ ਖਾਣਾ ਸੀ ਉਹ ਬਿਲਕੁਲ ਹੀ ਸਵਾਦ ਨਹੀਂ ਸੀ ਉਹ ਉਹਦੇ ਵਿੱਚ ਬਹੁਤ ਜ਼ਿਆਦਾ ਤੇਲ ਸੀ ਅਤੇ ਮਸਾਲੇ ਵੀ ਬਹੁਤ ਜ਼ਿਆਦਾ ਸੀ ਤੁਹਾਡੇ ਹੋਟਲ ਦਾ ਨਾਮ ਮੈਂ ਬਹੁਤ ਜ਼ਿਆਦਾ ਸੁਣਿਆ ਸੀ ਮ ਮੈਨੂੰ ਤੁਹਾਡਾ ਹੋਟਲ ਬਹੁਤ ਪਸੰਦ ਸੀ ਬਟ ਉਸ ਖਾਣੇ ਨੂੰ ਦੇਖ ਕੇ ਮੈਨੂੰ ਬਿਲਕੁਲ ਵੀ ਸੰਤੁਸ਼ਟੀ ਨਹੀਂ ਹੋਈ ਕਿਉਂਕਿ ਉਹ ਮੇਰਾ ਓਵਰਔਲ ਐਕਸਪੀਰੀਐਂਸ ਜੋ ਹੈ ਉਹ ਬਹੁਤ ਬੁਰਾ ਰਿਹਾ ਕਿਉਂਕਿ ਉਹ ਖਾਣਾ ਬਿਲਕੁਲ ਵੀ ਖਾਣ ਯੋਗ ਨਹੀਂ ਸੀ ਰੋਟੀ ਬਿਲਕੁਲ ਵੀ ਚਬਾਈ ਨਹੀਂ ਜਾ ਰਹੀ ਸੀ ਸਬਜ਼ੀਆਂ ਵਿੱਚ ਬਹੁਤ ਜ਼ਿਆਦਾ ਮਸਾਲੇ ਸੀ ਅਤੇ ਬਹ ਚ ਬਹੁਤ ਜ਼ਿਆਦਾ ਤੇਲ ਸੀ ਔਰ ਜਿਹੜੀ ਵੀ ਅਤੇ ਜਿਹੜੀ ਵੀ ਮਤਲਬ ਮਿੱਠੀ ਚੀਜ਼ ਸੀ ਗੁਲਾਬ ਜਾਮੁਨ ਸੀ ਉਹ ਵੀ ਬਿਲਕੁਲ ਚਬਾਉਣ ਯੋਗ ਨਹੀਂ ਸੀ ਉਹ ਬਿਲਕੁਲ ਵੀ ਚਬਾਏ ਨਹੀਂ ਜਾ ਸਕਦੇ ਸੀ ਇਸ ਕਰਕੇ ਮੇਰੀ ਤੁਹਾਡੇ ਹੋਟਲ ਦੇ ਨਾਲ ਓਵਰਔਲ ਸੰਤੁਸ਼ਟੀ ਜੋ ਹੈ ਉਹ ਨਹੀਂ ਹੋਈ ਅਤੇ ਮੇਰਾ ਓਵਰਔਲ ਐਕਸਪੀਰੀਐਂਸ ਬਹੁਤ ਬੁਰਾ ਰਿਹਾ